ਪਿੰਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕ੍ਰਿਕਟ ਹੋਇਆ ਵੋਲੀਬੋਲ ਹੋਇਆ ਫੁੱਟਬਾਲ ਹੋਇਆ ਇਹਨਾਂ ਨੂੰ ਬੜੇ ਧਿਆਨ ਨਾਲ ਖੇਡਣਾ ਚਾਹੀਦਾ ਆ ਜਿੱਦਾਂ ਕਿ ਆਲੇ ਦੁਆਲੇ ਲੋਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਕਿਸੇ ਨੂੰ ਸੱਟ ਚੋਟ ਨਾ ਲੱਗੇ ਆਪਣੇ ਇਕੱਠੇ ਦੋਸਤ ਮਿੱਤਰ ਖੇਡ ਕੇ ਇੱਕ ਦੂਜੇ ਨਾਲ ਹਾਸਾ ਮਖੌਲ ਜ਼ਰੂਰ ਕਰੋ ਗੇਮਾਂ ਆਪਣੀ ਸਿਹਤ ਦਾ ਖਿਆਲ ਰੱਖੋ ਗੇਮਾਂ ਜ਼ਰੂਰ ਖੇਡੋ ਪਰ ਇਹ ਵੀ ਖਿਆਲ ਰੱਖੋ ਕਿ ਕਿਸੇ ਦੇ ਸੱਟ ਚੋਟ ਨਾ ਲੱਗੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਤੁਸੀਂ ਆਪਣੀ ਗੇਮ ਦੇ ਰੂਲਸ ਬਣਾਉ ਅਤੇ ਉਹਦੇ ਨਾਲ ਹੀ ਖੇਡੋ